ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਤੁਸੀਂ ਮਨਸੁੱਖ ਢਾਗ ਢਾਬੇ ਤੋਂ ਬੋਲ ਰਹੇ ਹੋ ਮੈਨੇਜਰ ਸਾਹਿਬ ਬੋਲ ਰਹੇ ਹਾਂਜੀ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਮੈਂ ਤੁਹਾਨੂੰ ਆਰਡਰ ਦਿੱਤਾ ਸੀ ਜੀ ਤਕਰੀਬਨ ਪੰਦਰਾਂ ਜਣਿਆ ਦਾ ਸੀਗਾ ਇਹ ਆਰਡਰ ਅਤੇ ਇਹਦੇ ਵਿੱਚ ਮੈਂ ਪੰਦਰਾਂ ਜਣਿਆ ਦੇ ਅਕੋਰਡਿੰਗ ਤੀਹ ਰੋਟੀਆਂ ਅਤੇ ਇੱਕ ਕੜਾਹੀ ਪਨੀਰ ਅਤੇ ਰਾਇਤਾ ਅਤੇ ਨਾਲ ਸਲਾਦ ਆਰਡਰ ਕੀਤਾ ਸੀ ਅਤੇ ਮੈਨੂੰ ਇਹ ਹੀ ਆਰਡਰ ਸ਼ਾਮ ਦੇ ਸੱਤ ਵਜੇ ਚਾਹੀਦਾ ਸੀ ਜਦ ਮੇਰੇ ਕੋਲ ਆਰਡਰ ਪਹੁੰਚਿਆ ਅਤੇ ਇਹ ਆਰਡਰ ਜਿਸ ਤਰ੍ਹਾਂ ਮੈਂ ਪੈਕ ਕਰਨ ਨੂੰ ਕਿਹਾ ਸੀ ਉਸ ਤਰ੍ਹਾਂ ਨਹੀਂ ਸੀ ਜਦੋਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਦਸ ਜਣਿਆ ਦਾ ਜਿਹੜਾ ਆਰਡਰ ਆ ਉਹ ਇੱਕ ਥਾਂ ਤੇ ਕਰਨਾ ਹੈ ਪੈਕ ਅਤੇ ਪੰਜ ਜਣਿਆਂ ਦਾ ਇੱਕ ਸਾਈਡ ਉੱਤੇ ਕਰਨਾ ਤੁਸੀਂ ਕੀ ਕੀਤਾ ਮੈਨੂੰ ਪੰਦਰਾਂ ਜਣਿਆ ਦਾ ਆਰਡਰ ਇਕੱਠਾ ਦੇ ਦਿੱਤਾ ਜੋ ਕਿ ਤੁਹਾਡੇ ਬਹੁਤ ਗਲਤ ਗੱਲ ਹੈ ਕਿਉਂਕਿ ਇਹ ਪੰਜ ਜਿਹੜੇ ਜਣੇ ਸੀ ਮੈਂ ਕਿਧਰੇ ਹੋਰ ਭੇਜਣਾ ਸੀ ਮੈਨੂੰ ਘਰ ਵਿੱਚ ਸਿਰਫ਼ ਦਸ ਵਾਸਤੇ ਚਾਹੀਦਾ ਸੀ ਅਤੇ ਤੁਸੀਂ ਸਾਰਾ ਕੰਮ ਮੇਰਾ ਗਲਤ ਕਰ ਦਿੱਤਾ ਹੁਣ ਮੇਰੇ ਜਿਹੜੇ ਮਹਿਮਾਨ ਨੇ ਉੱਧਰ ਜਿਹੜੇ ਬਾਹਰ ਬੈਠੇ ਨੇ ਉਹ ਪੰਜ ਬਿਨਾਂ ਖਾਣੇ ਤੋਂ ਰਹਿ ਜਾਣਗੇ ਅਤੇ ਸ਼ਾਮ ਦੇ ਸੱਤ ਵੱਜ ਚੁੱਕੇ ਨੇ ਹੁਣ ਦੱਸੋ ਮੈਂ ਕੀ ਕਰਾਂ ਤੁਹਾਡੀ ਇਹ ਡਿਲੀਵਰੀ ਵਾਲਿਆਂ ਦੀ ਗਲਤ ਗੱਲ ਹੈ ਜਾਂ ਤੁਹਾਡੀ ਗਲਤ ਗੱਲ ਆ ਜਾਂ ਤੁਹਾਡੀ ਮਨ ਮੈਨੇਜਮੈਂਟ ਦੀ ਆ ਤੁਹਾਨੂੰ ਇਹ ਦੇਖਣਾ ਚਾਹੀਦਾ ਮੈਂ ਤੁਹਾਡੇ ਆਰਡਰ ਤੋਂ ਬਹੁਤ ਨਿਰਾਸ਼ਾ ਜ ਜਨਕ ਮਤਲਬ ਕਿ ਮੈਨੂੰ ਮਿਲਿਆ ਇਹ ਅਤੇ ਤੁਸੀਂ ਐਵੇਂ ਕਰ ਸਕਦੇ ਹੋ ਕਿ ਜਿਹੜਾ ਇਹ ਫੂ ਤੁਸੀਂ ਭੇਜਿਆ ਮੈਨੂੰ ਆਰਡਰ ਇਹ ਆਪਣਾ ਜਾਂ ਤਾਂ ਤੁਸੀਂ ਰਿਫੰਡ ਕਰ ਲਓ ਜਾਂ ਮੈਨੂੰ ਸਹੀ ਕਰਕੇ ਇੱਕ ਘੰਟੇ ਦੇ ਅੰਦਰ ਅੰਦਰ ਦੁਬਾਰਾ ਤੁਸੀਂ ਮੈਨੂੰ ਭੇਜ ਸਕਦੇ ਹੋ